ਹੈਲੋ ਸਰ ਤੁਸੀਂ ਫਲਿਪਕਾਰਟ ਤੋਂ ਬੋਲ ਰਹੇ ਹੋ ਮੈਂ ਤੁਹਾਡੇ ਕੋਲੋਂ ਪ੍ਰੋਡੈਕਟ ਖਰੀਦਿਆ ਸੀ ਫਰਿੱਜ ਅਤੇ ਐੱਲ ਜੀ ਦੀ ਉਹ ਕੋਂਪਨੀ ਸੀ ਅਤੇ ਮੀਡੀਅਮ ਸਾਈਜ਼ ਸੀਗਾ ਅਤੇ ਕਲਰ ਉਸ ਦਾ ਗਰੇ ਸੀਗਾ ਅਤੇ ਬਹੁਤ ਹੀ ਸੋਹਣਾ ਕਲਰ ਹੈ ਅਤੇ ਮੇਰੇ ਕਿਚਨ ਵਿੱਚ ਲੱਗੇ ਹੋਏ ਬੋਕਸ ਸੇਮ ਉਹਨਾਂ ਦੇ ਨਾਲ ਹੀ ਮੈਚ ਹੋ ਗਿਆ ਅਤੇ ਚੱਲਣ ਵਿੱਚ ਵੀ ਇਹ ਬਹੁਤ ਹੀ ਵਧੀਆ ਅਤੇ ਇਸ ਦੇ ਅੰਦਰ ਖਾਨੇ ਵੀ ਬਹੁਤ ਅੱਛੇ ਬਣੇ ਹੋਏ ਨੇ ਅਤੇ ਨੀਚੇ ਸਬਜ਼ੀ ਵਗੈਰਾ ਰੱਖਣ ਵਾਲਾ ਵੀ ਬੋਕਸ ਵਧੀਆ ਬਣਿਆ ਹੈ ਸਾਈਡ 'ਤੇ ਬੋਤਲ ਵਗੈਰਾ ਵੀ ਰੱਖ ਸਕਦੇ ਹਾਂ ਅਤੇ ਬਿਜਲੀ ਬਿਜਲੀ ਵੀ ਬਹੁਤ ਘੱਟ ਤੋਂ ਘੱਟ ਹੀ ਖਿੱਚਦੀ ਹੈ ਅਤੇ ਵਧੀਆ ਜਗ੍ਹਾ ਵੀ ਇਸਦੀ ਘੱਟ ਹੀ ਮੱਲਦੀ ਹੈ ਅਤੇ ਫਰਿੱਜ ਬਹੁਤ ਹੀ ਵਧੀਆ ਸੀ ਅਤੇ ਕੂਲਿੰਗ ਵੀ ਬਹੁਤ ਹੀ ਵਧੀਆ ਕਰਦੇ ਨੇ ਕਰਦੀ ਆ ਇਕ ਦੋ ਦਿਨ ਇਹਦੇ ਅੰਦਰ ਕੂਲਿੰਗ ਰਹਿੰਦੀ ਹੀ ਰਹਿੰਦੀ ਹੈ ਫਰਿੱਜ ਲਗਾਓ ਇੱਕ ਦਿਨ ਲਗਾਓ ਦੋ ਤਿੰਨ ਦਿਨ ਤਾਂ ਕੂਲਿੰਗ ਰਹਿੰਦੀ ਰਹਿੰਦੀ ਹੈ ਬਰਫ਼ ਬਹੁਤ ਵਧੀਆ ਬਣਦੀ ਹੈ ਇਸ ਕਾਰਨ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਜੋ ਮੈਂ ਤੁਹਾਡੇ ਕੋਲੋਂ ਪ੍ਰੋਡੈਕਟ ਲਿਆ ਸੀ ਅਤੇ ਉਹ ਬਹੁਤ ਹੀ ਵਧੀਆ ਰਿਹਾ ਅਤੇ ਇਸ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ